ਸ਼ੁਰੂਆਤੀ ਦਹਾਕਿਆਂ ਦੇ ਵਿੱਚ ਲੈਂਡਲਾਈਨ ਫੋਨ ਦੀ ਵਰਤੋਂ ਕੀਤੀ ਜਾਂਦੀ ਸੀ ਜਦੋਂ ਕਿ ਫਿਰ ਕੀਪੈਡ ਫੋਨ ਆਏ ਅਤੇ ਅੱਜ ਕੱਲ੍ਹ ਸਮਾਰਟ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ ਸ਼ੁਰੂਆਤੀ ਫੋਨ ਸਿਰਫ ਕਾਲਿੰਗ ਲਈ ਹੀ ਵਰਤੇ ਜਾਂਦੇ ਸੀ ਜੇਕਰ ਆਪਾਂ ਨੇ ਇੱਕ ਬੰਦੇ ਤੋਂ ਦੂਜੇ ਵਿਅਕਤੀ ਤੱਕ ਗੱਲ ਕਰਨੀ ਹੋਵੇ ਤਾਂ ਅਸੀਂ ਸਿਰਫ਼ ਉਸ ਫੋਨ 'ਤੇ ਗੱਲ ਹੀ ਕਰ ਸਕਦੇ ਸੀ ਬਲਕਿ ਮੌਜੂਦਾ ਸਮਾਰਟ ਫੋਨ ਦੇ ਵਿੱਚ ਬਹੁਤ ਸਾਰੇ ਫੀਚਰਸ ਵੀ ਆਉਂਦੇ ਹਨ ਜਿਵੇਂ ਕਿ ਅਸੀਂ ਇੱਕ ਦੂਜੇ ਦੇ ਨਾਲ ਗੱਲ ਕਰਨ ਦੇ ਨਾਲ ਨਾਲ ਉਸ ਦੇ ਵਿੱਚ ਗਣਿਤ ਦਾ ਇਸਤੇਮਾਲ ਵੀ ਕਰ ਸਕਦੇ ਹਾਂ ਉਸਦੇ ਵਿੱਚ ਅਸੀਂ ਆਪਣੀ ਯਾਦਾਂ ਅਤੇ ਫੋਟੋ ਅਤੇ ਵੀਡੀਓ ਦੇ ਰੂਪ ਵਿੱਚ ਵੀ ਸੇਵ ਕਰ ਸਕਦੇ ਹਾਂ ਅਤੇ ਜੇ ਕਿਸੇ ਨਾਲ ਦੂਰ ਬੈਠੇ ਨਾਲ ਅਸੀਂ ਵੀਡੀਓ ਰਾਹੀਂ ਗੱਲ ਕਰਨੀ ਹੋਵੇ ਤਾਂ ਵੀਡੀਓ ਕਾਲ ਵੀ ਕਰ ਸਕਦੇ ਹਾਂ ਅਤੇ ਅਸੀਂ ਇਸਦੇ ਵਿੱਚ ਯੂ ਪੀ ਆਈ ਦੇ ਰਾਹੀਂ ਅੱਜ ਕੱਲ੍ਹ ਪੇਮੈਂਟ ਵੀ ਕਰ ਸਕਦੇ ਹਾਂ ਜੇਕਰ ਕਾਲ ਵਗੈ ਕਾਲ ਕਰਨ ਜਾਂ ਚੱਕਣ ਦੀ ਅਵਸਥਾ ਨਾ ਹੋਵੇ ਤਾਂ ਸਮਾਰਟ ਫੋਨ ਦੇ ਵਿੱਚ ਅਸੀਂ ਮੈਸੇਜਿਜ਼ ਵੀ ਕਰ ਸਕਦੇ ਹਾਂ ਇਹਨਾਂ ਨਾਲੋਂ ਪਹਿਲਾਂ ਦੇ ਫੋਨਾਂ ਦੇ ਨਾਲੋਂ ਅੱਜ ਕੱਲ੍ਹ ਦੇ ਫੋਨਾਂ ਦੇ ਵਿੱਚ ਬਹੁਤ ਸਾਰੇ ਫੀਚਰ ਪਾ ਦਿੱਤੇ ਗਏ ਹਨ ਸਮਾਰਟ ਫੋਨ ਦੀ ਵਰਤੋਂ ਮਨੋਰੰਜਨ ਦੇ ਸਾਧਨਾਂ ਲਈ ਵੀ ਕੀਤੀ ਜਾਂਦੀ ਹੈ ਜੋ ਕਿ ਪਹਿਲਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਨਹੀਂ ਹੁੰਦੀ ਸੀ ਸਮਾਰਟ ਫੋਨਾਂ ਦੇ ਵਿੱਚ ਮਨੋਰੰਜਨ ਦਾ ਸਾਧਨ ਬਣਦੇ ਹਨ ਜਿਵੇਂ ਕਿ ਅਸੀਂ ਫਿਲਮਾਂ ਦੇਖ ਸਕਦੇ ਹਾਂ ਉਸਦੇ ਵਿੱਚ ਗੇਮਾਂ ਖੇਡ ਸਕਦੇ ਹਾਂ ਪਹਿਲਾਂ ਦੇ ਨੈੱਟਵਰਕ ਕੁਛ ਉਹਨਾਂ ਦੀ ਸਪੀਡ ਥੋੜ੍ਹੀ ਜਿਹੀ ਘੱਟ ਹੁੰਦੀ ਸੀ ਜਿਸ ਕਾਰਨ ਸਾਨੂੰ ਸਾਡਾ ਖੋਜੀ ਜਾਣ ਵਾਲੀ ਚੀਜ਼ ਬਹੁਤ ਹੀ ਜ਼ਿਆਦਾ ਟਾਈਮ ਦੇ ਨਾਲ ਮਿਲਦੀ ਸੀ ਅਤੇ ਉਹਨਾਂ ਦੇ ਵਿੱਚ ਗੱਲ ਕਰਨ ਦੇ ਵਿੱਚ ਵੀ ਸਮੱਸਿਆ ਹੁੰਦੀ ਸੀ ਅੱਜ ਕੱਲ੍ਹ ਦੇ ਕਨੈਕਸ਼ਨ ਦੇ ਵਿੱਚ ਜਿਵੇਂ ਕਿ ਫਾਈਵ ਜੀ ਸਪੀਡ ਵਰਤੀ ਜਾਂਦੀ ਹੈ ਜਿਸਦੇ ਵਿੱਚ ਵੱਡੀਆਂ ਵੱਡੀਆਂ ਫਾਇਲਾਂ ਕੁਛ ਚੰਦ ਹੀ ਮਿੰਟਾਂ ਦੇ ਵਿੱਚ ਡਾਊਨਲੋਡ ਹੋ ਜਾਂਦੀਆਂ ਹਨ ਅਤੇ ਅਸੀਂ ਆਪਣਾ ਕੰਮ ਜਾਰੀ ਰੱਖ ਸਕਦੇ ਹਾਂ ਬਿਨਾਂ ਹੀ ਕਿਸੇ ਅੜਚਨ ਤੋਂ ਮੈਂ ਏਅਰਟੈਲ ਦੀ ਸਿੰਮ ਦੀ ਵਰਤੋਂ ਕਰ ਰਿਹਾ ਹਾਂ ਜਿਸਦੇ ਵਿੱਚ ਮੈਂ ਰਿਚਾਰਜ ਬਦਲਵੇਂ ਰੱਖਦਾ ਹਾਂ ਅਤੇ ਲੋੜ ਪੈਣ 'ਤੇ ਵੱਡਾ ਰੀਚਾਰਜ ਵੀ ਕਰਵਾ ਲੈਂਦਾ ਹਾਂ ਮੇਰੇ ਡੈ ਮੈਂ ਆਪਣੇ ਮਹੀਨਾਵਾਰ ਦੇ ਡਾਟਾ ਪੈਕ 'ਤੇ ਸੱਤ ਸੌ ਵੀਹ ਰੁਪਏ ਖ਼ਰਚ ਕਰਦਾ ਹਾਂ